ਸਤਿ ਸ਼੍ਰੀ ਅਕਾਲ ਜੀ ਮੈਂ ਭਾਵੀਕਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਪਿਛਲੇ ਸਾਲ ਹੀ ਮੈਂ ਅਠਾਰ੍ਹਾਂ ਸਾਲਾਂ ਦੀ ਹੋਈ ਸੀ ਮੈਂ ਆਪਣੇ ਵੋਟਰ ਕਾਰਡ ਵੀ ਪਿਛਲੇ ਸਾਲ ਹੀ ਬਣਾ ਲਿਆ ਸੀ ਅਤੇ ਇਸ ਸਾਲ ਮੈਂ ਆਪਣਾ ਪਹਿਲਾ ਵੋਟ ਪਾਇਆ ਹੈ ਚੋਣ ਦੌਰਾਨ ਪਹਿਲੀ ਸਮੱਸਿਆ ਤਾਂ ਇਹ ਹੁੰਦੀ ਹੈ ਕਿ ਅਸੀਂ ਆਪਣਾ ਵੋਟ ਕਿਸ ਨੂੰ ਦਈਏ ਸਾਨੂੰ ਆਪਣਾ ਵੋਟ ਹਮੇਸ਼ਾ ਉਸ ਉਮੀਦਵਾਰ ਨੂੰ ਦੇਣਾ ਚਾਹੀਦਾ ਹੈ ਜੋ ਕਿ ਸਾਡੀਆਂ ਸਮੱਸਿਆਵਾਂ ਦਾ ਹੱਲ ਕਰਦਾ ਹੋਵੇ ਸਾਡੀ ਗੱਲ ਸੁਣਦਾ ਹੋਵੇ ਅਤੇ ਸਾਡੇ ਸਮਾਜ ਲਈ ਕੰਮ ਕਰਦਾ ਹੋਵੇ ਮੈਂ ਵੀ ਆਪਣਾ ਵੋਟ ਇਕ ਐਸੇ ਹੀ ਉਮੀਦਵਾਰ ਨੂੰ ਦੇਣ ਦਾ ਫੈਸਲਾ ਕੀਤਾ ਫੇਰ ਜਦੋਂ ਆਖਰ ਚੋਣ ਦਾ ਦਿਨ ਆਇਆ ਤਾਂ ਪਹਿਲਾਂ ਤਾਂ ਮੈਨੂੰ ਪੁਲਿੰਗ ਬੂਥ ਤੱਕ ਪਹੁੰਚਣ ਵਿੱਚ ਬਹੁਤ ਪਰੇਸ਼ਾਨੀ ਹੋਈ ਫੇਰ ਉੱਥੇ ਪਹੁੰਚ ਕੇ ਸਾਨੂੰ ਕਿੰਨੀ ਦੇਰ ਕਤਾਰ ਵਿੱਚ ਲੱਗ ਕੇ ਧੁੱਪ ਦਾ ਸਾਹਮਣਾ ਕਰਨਾ ਪਿਆ ਅੰਤ ਵਿੱਚ ਕਾਫੀ ਦੇਰ ਬਾਅਦ ਮੇਰਾ ਨੰਬਰ ਆਇਆ ਅਤੇ ਮੈਂ ਆਪਣੀ ਵੋਟ ਪਾ ਕੇ ਘਰ ਆ ਗਈ ਧੰਨਵਾਦ